ਸਾਡੇ ਇਲਾਕੇ ਵਿੱਚ ਬਹੁਤ ਸਾਰੇ ਪ੍ਰਾਈਵੇਟ ਬੈਂਕ ਹਨ ਜਿਵੇਂ ਕੀ ਐਚਡੀਐਫਸੀ ਆਈਸੀਆਈਸੀਆਈ ਏਯੂ ਫਾਈਨੈਂਸ ਬੈਂਕ ਇਹ ਸਾਰੇ ਪ੍ਰਾਈਵੇਟ ਬੈਂਕ ਹਨ ਕਰਜ਼ੇ ਅਤੇ ਬੀਮਾ ਲਈ ਅਰਜ਼ੀ ਦੇਣ ਲਈ ਸਾਨੂੰ ਜ਼ਿਆਦਾਤਰ ਸਰਕਾਰੀ ਬੈਂਕ ਹੀ ਕੰਮ ਆਉਂਦੇ ਹਨ ਸਰਕਾਰੀ ਬੈਂਕ ਜਿਵੇਂ ਸਟੇਟ ਬੈਂਕ ਓਫ ਇੰਡੀਆ ਯਾਨੀ ਐਸਬੀਆਈ ਹੋ ਗਿਆ ਇਹ ਬੈਂਕ ਅਸੀਂ ਪ੍ਰੈਫਰੈਂਸ ਵਿੱਚ ਪਾਉਨੇ ਹਾਂ ਕਿਉਂਕੀ ਇਹ ਸਰਕਾਰੀ ਬੈਂਕ ਹੈ ਤਾਂ ਇੱਥੇ ਸਿਕਿਓਰਿਟੀ ਵੀ ਜ਼ਿਆਦਾ ਹੁੰਦੀ ਹੈ ਆਪਣੇ ਪੈਸੇ ਵੀ ਜ਼ਿਆਦਾ ਚੱਜ ਨਾਲ ਰਹਿੰਦੇ ਹਨ ਨਾਲੇ ਪ੍ਰਾਈਵੇਟ ਬੈਂਕਾਂ ਦੇ ਕਈ ਹਿਡਨ ਚਾਰਜਿਸ ਵੀ ਹੁੰਦੇ ਹਨ ਜਿਹੜੇ ਕੀ ਆਪਾਂ ਨੂੰ ਉੱਥੇ ਜਾ ਕੇ ਹੀ ਪਤਾ ਚੱਲਦੇ ਹਨ ਕਈ ਵਾਰੀ ਕਰਜ਼ੇ ਦੀ ਵਾਪਿਸ ਪੁਗਾਈ ਕਰਦੇ ਹਾਂ ਜਦੋਂ ਉਦੋਂ ਬਾਅਦ ਜਾ ਕੇ ਪਤਾ ਚੱਲਦਾ ਹੈ ਕਿ ਜੇ ਅਸੀਂ ਇੱਕ ਲੱਖ ਦਾ ਕਰਜ਼ਾ ਲਿੱਤਾ ਹੈ ਤਾਂ ਆਪਾਂ ਨੂੰ ਇੰਟਰਸਟ ਪੈ ਕੇ ਇੱਕ ਲੱਖ ਤੀਹ ਹਜ਼ਾਰ ਦੇਣਾ ਪੈ ਜਾਂਦਾ ਹੈ ਇਹ ਸਭ ਪ੍ਰਾਈਵੇਟ ਬੈਂਕਾਂ ਉੱਤੇ ਹੁੰਦਾ ਹੈ ਜਿਹੜੇ ਸਰਕਾਰੀ ਬੈਂਕ ਹੁੰਦੇ ਹਨ ਉਹ ਆਪਾਂ ਨੂੰ ਪਹਿਲੇ ਹੀ ਦੱਸ ਦਿੰਦੇ ਹਨ